ਮੈਂ ਪੰਜਵੀਂ ਕਲਾਸ ਤੋਂ ਬਾਅਦ ਸਿਲਾਈ ਕਰਨੀ ਸ਼ੁਰੂ ਕਰ ਦਿੱਤੀ ਸੀ ਮੈਂ ਸਿਲਾਈ ਦੀ ਬਹੁਤ ਮਾਹਿਰ ਹਾਂ ਮੈਂ ਸਿਲਾਈ ਆਪ ਸਿੱਖ ਕੇ ਅਗਾਂਹ ਕੁੜੀਆਂ ਨੂੰ ਵੀ ਸਿਲਾਈ ਸਿਖਾਉਣ ਦਾ ਤਾ ਤਜਰਬਾ ਹੈ ਇਸ ਲਈ ਮੈਂ ਸਿਲਾਈ ਦੀ ਬਹੁਤ ਓ ਮੈਂ ਬਟੀਕ ਵੀ ਖੋਲ੍ਹਿਆ ਹੋਇਆ ਹੈ ਮੈਂ ਸਿਲਾਈ ਕਰਦੀ ਹਾਂ ਮੈਂ ਪਹਿਲਾਂ ਤਾਂ ਛੋਟੀ ਹੁੰਦੀ ਤੋਂ ਤਾਂ ਖੁੱਲ੍ਹੀ ਮੂਰੀ ਦੀ ਆਪਾਂ ਨੂੰ ਸੀਗਾ ਵੀ ਛੋਟੀ ਵੱਡੀ ਮੂਰੇ ਪਾਉਂਦੇ ਸੀ ਅੱਜ ਕੱਲ੍ਹ ਫੈਸ਼ਨ ਦੇ ਤੌਰ 'ਤੇ ਛੋਟੀ ਮੂਰੀ ਬਣਾਈ ਜਾਂਦੀ ਹੈ ਇਸ ਕਰਕੇ ਸਿਲਾਈ ਪਹਿਲਾਂ ਬੁਕਰਮ ਪਾਓ ਬੁਕਰਮ ਦੇ ਵਿੱਚ ਸਟਰੋਲਾਂ ਮਾਰੋ ਸਟਰੋਲਾਂ ਤੋਂ ਬਾਅਦ ਫਿਰ ਆਪਾਂ ਸਲਵਾਰ ਦੀ ਮੂਰੀ ਤਿਆਰ ਕਰੋ ਇਸ ਲਈ ਇਹ ਮੈਨੂੰ ਸਿਲਾਈ ਦਾ ਬਹੁਤ ਸ਼ੌਂਕ ਹੈ ਮੈਂ ਬਹੁਤ ਬੱਚਿਆਂ ਨੂੰ ਸਿਖਾਉਂਦੀ ਹਾਂ ਇਸ ਲਈ ਮੈਂ ਬਹੁਤ ਸੋਹਣੀ ਸਲਵਾਰ ਤਿਆਰ ਕਰਦੀ ਹਾਂ ਮੈਨੂੰ ਸਲਵਾਰ ਸਲਵਾਰਾਂ ਬਣਾਉਣੀਆਂ ਬਹੁਤ ਪਸੰਦ ਹਨ ਇਸ ਕਰਕੇ ਮੈਂ ਸਿਲਾਈ ਸਿਖਾ ਵੀ ਰਹੀ ਹਾਂ ਅੱਜ ਤਾਂ ਮੇਰਾ ਬਟੀਕ ਬਹੁਤ ਵਧੀਆ ਚੱਲ ਰਿਹਾ ਹੈ ਸਲਵਾਰਾਂ ਬਹੁਤ ਬਣਾ ਰਹੀ ਹਾਂ ਮੈਂ ਇਸ ਕਰਕੇ ਮੈਨੂੰ ਸਿਲਾਈ ਦਾ ਬਹੁਤ ਸ਼ੌਂਕ ਹੈ ਸਲਵਾਰਾਂ ਦੀ ਮੂਰੀ ਕਈ ਤਰ੍ਹਾਂ ਦੇ ਡਿਜ਼ਾਇਨਾਂ ਨਾਲ ਬਣਾਈ ਜਾਂਦੀ ਹੈ ਇਸ ਕਰਕੇ ਮੈਂ ਸਿਲਾਈ ਦੀ ਮੂਰੀ ਦੀ ਬਹੁਤ ਮਾਹਿਰ ਹਾਂ ਸਿਲਾਈ ਦਾ ਮੈਨੂੰ ਬਹੁਤ ਵੱਡਾ ਕੋਰਸ ਹੈ ਮੇਰੇ ਕੋਲ ਇਸ ਕਰਕੇ ਮੈਂ ਸਿਲਾਈ ਸੈਂਟਰ ਵਿੱਚ ਖੋਲ੍ਹਿਆ ਹੋਇਆ ਹੈ ਤਾਂ ਕਰਕੇ ਮੇਰੇ ਕੋਲ ਬਹੁਤ ਬੱਚੀਆਂ ਕੰਮ ਕਰਦੀਆਂ ਹਨ ਇਸ ਟਾਈਮ ਮੈਂ ਸਿਲਾਈ ਦੀਆਂ ਸਟਰੋਲਾਂ ਉਹਨਾਂ ਨੂੰ ਕਈ ਤਰ੍ਹਾਂ ਦੇ ਡਿਜ਼ਾਇਨਾਂ ਵਿੱਚ ਦੱਸਦੀ ਹਾਂ ਮੈਂ ਸਿੱਧਾ ਹੀ ਨਹੀਂ ਦੱਸਦੀ ਮੈਂ ਸਟਰੋਲਾਂ ਕਈ ਫੈਸ਼ਨਾਂ ਨਾਲ ਬਣਾ ਰਹੀ ਹਾਂ ਇਸ ਕਰਕੇ ਮੈਂ ਬੱਚੀਆਂ ਨੂੰ ਸਿਖਾ ਰਹੀ ਹਾਂ